ਹਾਂਜੀ ਨਮਨ ਸਰ ਬੋਲ ਰਹੇ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਮਨਜੋਤ ਬੋਲ ਰਿਹਾ ਸੀ ਐੱਸ ਟੀ ਬੈਚ ਤੋਂ ਦੋ ਹਜ਼ਾਰ ਬਾਈ ਅਤੇ ਸਰ ਉਹ ਪੁੱਛਣਾ ਸੀ ਮੈਂ ਅਸਾਈਨਮੈਂਟ ਦਿੱਤੀ ਨਹੀ ਸੀ ਜਿਹੜੀ ਤੁਸੀਂ ਪਹਿਲੀ ਜਿਹਦੇ 'ਚ ਫਰੀਡਮ ਫਾਈਟਰ ਬਾਰੇ ਕਿਹਾ ਸਰ ਤੁਸੀਂ ਹਾਂਜੀ ਹਾਂਜੀ ਸਰ ਉਹਦੇ ਬਾਰੇ ਪੁੱਛਣਾ ਜੀ ਸਰ ਉਹ ਪੁੱਛਣਾ ਜੇ ਫਰੀਡਮ ਫਾਈਟਰ ਮਤਲਬ ਜੇ ਆਪਾਂ ਡੈਫੀਨੇਸ਼ਨ ਲਿਖਣੀ ਕਿੱਦਾਂ ਕਿੱਦਾਂ ਸਾਰਾ ਕੁਝ ਲਿਖੀਏ ਗਰਾਫ ਜੋ ਵੀ ਬਣਾਉਣਾ ਹਾਂਜੀ

ਹਾਂਜੀ ਹਾਂਜੀ

ਹਾਂਜੀ ਹਾਂਜੀ ਸਰ ਸਮਝ ਗਿਆ

ਅੱਛਾ ਸਰ ਸਰ ਉਹ ਪੁੱਛਣਾ ਸੀ ਜਿੱਦਾਂ ਹੁਣ ਭਗਤ ਸਿੰਘ ਸੀਗੇ ਇੱਕ ਤਾਂ ਯਾਦ ਹੈ ਮੈਨੂੰ ਅਤੇ ਕਰਤਾਰ ਸਿੰਘ ਸਰਾਭਾ ਅਤੇ ਹੋਰ ਕਿਹੜੇ ਸੀਗੇ ਹਾਂਜੀ ਹਾਂਜੀ ਊਧਮ ਸਿੰਘ ਅਤੇ ਉਹ ਭਗਤ ਸਿੰਘ ਦੇ ਹਿਸਟਰੀ ਬਾਰੇ ਸਾਰਾ ਹੀ ਲਿਖਣਾ ਜੀ ਸਾਰਾ ਕੁਛ ਜਿੱਦਾਂ ਮੈਨੂੰ ਨੋਲੇਜ ਘੱਟ ਹੀ ਆ ਨਾ ਸਰ ਇਹ ਚੀਜ਼ ਬਾਰੇ ਹਾਂਜੀ ਅਤੇ ਮਤਲਬ ਜਿੱਦਾਂ ਭਗਤ ਸਿੰਘ ਬਾਰੇ ਪਿੰਡ ਪੁੰਡ ਸਾਰਾ ਕੁਛ ਲਿਖਣਾ ਜੀ ਹੈ ਨਾ ਅੱਛਾ ਜੀ ਤਾਂ ਅਤੇ ਹੋਰ ਵੀ ਸਰ ਕਿੰਨੇ ਤਿੰਨ ਲਿਖਣੇ ਕੇ ਪੰਜ

ਹਾਂਜੀ ਹਾਂਜੀ ਹਾਂਜੀ ਸਰ ਮੈਂ ਉਹ ਤਾਂ ਸਮਝ ਗਿਆ ਜੀ ਤੁਹਾਡੀ ਗੱਲ ਅਤੇ ਸਰ ਹੋਰ ਮਤਲਬ ਕਿ ਆਪਾਂ ਲਿਖ ਸਕਦੇ ਸਰ ਇਹਨਾਂ ਇਹਨਾਂ ਬਾਰੇ ਮੈਂ ਕਿਹਾ ਸਰ ਹੋਰ ਜਿੱਦਾਂ ਕਿ ਲਿਖ ਸਕਦੇ ਜਿੱਦਾਂ ਤਿੰਨ ਤਾਂ ਆਪਾਂ ਇਹ ਲਿਖ ਦਿੱਤੇ ਜੀ ਸਰ ਨੈੱਟ 'ਤੇ ਵੀ ਸਰ ਜਿਹੜੀਆਂ ਇਨਫੋਰਮੇਸ਼ਨ ਆ ਉਹ ਬਹੁਤ ਘੱਟ ਮਿਲੀ ਆ

ਠੀਕ ਹੈ ਸਰ ਠੀਕ ਹੈ ਸਰ ਅਤੇ ਭਗਤ ਸਿੰਘ ਆਪਣੇ ਜਿੱਦਾਂ ਮੈਂ ਉਹਨਾਂ ਦਾ ਪਿੰਡ ਬਾਰੇ ਲਿਖਦਾ ਜਿੱਦਾਂ ਰੁੜਕਾ ਰੁੜਕਾ ਕਲਾਂ 'ਚ ਰਹਿੰਦੇ ਸੀਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਇਹਨਾਂ ਦੇ ਮਤਲਬ ਪੂਰਾ ਹਾਂਜੀ ਇਹਨਾਂ ਦੇ ਹਾਂਜੀ ਮਤਲਬ ਕੀ ਜੇ ਧਰਤੀ ਸਰ ਜਿੱਦਾਂ ਇਹਨਾਂ ਨੇ ਇਹਨਾਂ ਨੇ ਮਤਲਬ ਮੇਨ ਮੇਨ ਸਰ ਲਾਈਨਾਂ ਚੁੱਕ ਕੇ ਲਿਖਤੀਆਂ ਇਹਨਾਂ ਜੀ ਹਾਂਜੀ ਜੋ ਜੋ ਮਤਲਬ ਇਹਨਾਂ ਦੇ ਉਹ ਸੀਗੇ ਮੋਰਲ ਵਗੈਰਾ

ਠੀਕ ਹੈ ਸਰ ਸਰ ਜੇ ਤੁਹਾਨੂੰ ਹੁਣ ਮੈਂ ਜਿੱਦਾਂ ਹੁਣ ਬਾਹਰ ਆ ਜੇ ਡਰਾਈਵ ਲਿੰਕ ਰਾਹੀਂ ਭੇਜ ਦੇਵਾਂ ਮੈਂ ਕਿਹਾ ਜਿੱਦਾਂ ਸਰ ਮੈਂ ਬਾਹਰ ਸੀਗਾ ਆਊਟ ਓਫ ਸੀਟੀ ਤਾਂ ਮੈਂ ਡਰਾਈਵ ਲਿੰਕ ਕਰਕੇ ਸੈਂਡ ਕਰ ਸਕਦਾ ਬਣਾ ਕੇ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਜੀ ਸਰ ਥੈਂਕ ਯੂ ਸੋ ਮਚ ਜੇ ਮੈਂ ਹੋਰ ਕੁਛ ਪੁੱਛਣਾ ਮੈਂ ਤੁਹਾਨੂੰ ਕੋਲ ਕਰ ਲਊਂਗਾ ਜੇ ਹੋਰ ਪੁੱਛਣਾ ਠੀਕ ਹੈ ਸਰ